ਕੁਝ ਸਥਾਨਕ ਸਰਕਾਰੀ ਪਹਿਲ ਕਰਮੀਆਂ ਨੇ ਜਿਨ੍ਹਾਂ ਨੇ ਸਾਡੇ ਜਿਲ੍ਹੇ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਜਿਵੇਂ ਕਿ ਸਾਡੇ ਪੰਜਾਬ ਵਿੱਚ ਸਾਡੇ ਜਿਲ੍ਹੇ ਸ਼ਹੀਦਪੁਰ ਭਗਤ ਸਿੰਘ ਨਗਰ ਵਿੱਚ ਕਾਫੀ ਨਸ਼ੇ ਦੇ ਆਦੀ ਬੱਚੇ ਨੇ ਅਤੇ ਜਿਹੜੇ ਨਸ਼ਾ ਕਰਦੇ ਨੇ ਅਤੇ ਸਾਡੇ ਜਿਲ੍ਹੇ ਨੇ ਉਸ ਵਿੱਚ ਨਸ਼ਾ ਛੁਡਾਉ ਕੇਂਦਰ ਵਗੈਰਾ ਖੋਲ੍ਹ ਕੇ ਬੱਚਿਆਂ ਨੂੰ ਇਸ ਲੱਤ ਤੋਂ ਛੁਟਕਾਰਾ ਪਾਇਆ ਹੈ ਜੋ ਕਿ ਸਾਡੇ ਜਿਲ੍ਹੇ ਲਈ ਬਹੁਤ ਹੀ ਮਹੱਤਵਪੂਰਨ ਅਤੇ ਵਧੀਆ ਗੱਲ ਹੈ ਇਸ ਤੋਂ ਇਲਾਵਾ ਸਾਡੇ ਜਿਲ੍ਹੇ ਨੇ ਬਿਰਧ ਆਸ਼ਰਮ ਖੁੱਲ੍ਹੇ ਨੇ ਜਿਵੇਂ ਕਿ ਜੋ ਵੀ ਬੁੱਢੇ ਬਜ਼ੁਰਗ ਨੇ ਜਿਨ੍ਹਾਂ ਦੇ ਮਾਂ ਬਾਪ ਬੱਚਿਆਂ ਨੇ ਆਪਣੇ ਮਾਂ ਬਾਪ ਨੂੰ ਅਲੱਗ ਕਰ ਦਿੱਤਾ ਹੈ ਉਹ ਉੱਥੇ ਰਹਿ ਕੇ ਆਪਣੀ ਅਗਲੀ ਸਾਰੀ ਜ਼ਿੰਦਗੀ ਬਸਰ ਕਰ ਸਕਦੇ ਹਨ ਅਤੇ ਰਹਿ ਸਕਦੇ ਹਨ